ਸਤਿ ਸ਼੍ਰੀ ਅਕਾਲ ਸਰ ਹਾਂਜੀ

ਸਰ ਮੈਂ ਤੁਹਾਨੂੰ ਦੱਸ ਸਕਦੀ ਹਾਂ ਕਿ ਇਹ ਪ੍ਰੋਬਲਮ ਕਿਉਂ ਆਈ ਆ ਕਿਉਂਕਿ ਜਿਹੜੀ ਆਪਣੀ ਤੁਹਾਡੀ ਆਹ ਬਿਜਨਸ ਆਪਣਾ ਉਹ ਬਹੁਤ ਹੀ ਵੱਡਾ ਹੈ ਅਤੇ ਜਿਸ ਕਰਕੇ ਜਿਹੜਾ ਤੁਸੀਂ ਇੱਕ ਹੀ ਅਕਾਊਂਟੈਂਟ ਹਾਇਰ ਕੀਤਾ ਅਤੇ ਜਿਸ ਨਾਲ ਜਿਹੜਾ ਹੈ ਜਿਹੜੀ ਮੈਂ ਅਕਾਊਂਟੈਂਟ ਹੈ ਇਸ ਲਈ ਮੈਂ ਇਹ ਇਹ ਸਭ ਕੁਛ ਮੈਨੇਜ ਨਹੀਂ ਕਰ ਪਾ ਰਹੀ ਮੇਰੇ ਤੋਂ ਇੰਨਾ ਸਭ ਕੁੱਛ ਹੈਂਡਲ ਨਹੀਂ ਹੋ ਪਾ ਰਿਹਾ ਤਾਂ ਇਸ ਇਹ ਪ੍ਰੋਬਲਮ ਨੂੰ ਸਹੀ ਕਰਨ ਲਈ ਤੁਹਾਨੂੰ ਇੱਕ ਹੋਰ ਅਕਾਊਂਟੈਂਟ ਨੂੰ ਹਾਇਰ ਕਰਨਾ ਪਏਗਾ

ਹਾਂਜੀ ਪੇ ਤਾਂ ਦੇਣੀ ਪਏਗੀ ਓਬਵੀਅਸਲੀ ਸਰ ਇਹ ਨਾ ਹੁਣ ਇਹ ਪ੍ਰੋਬਲਮ ਆਪਾਂ ਉੱਦਾਂ ਹੀ ਸਹੀ ਕਰ ਸਕਦੇ ਹਾਂ ਹੋਰ ਅਕਾਊਂਟੈਂਟ ਨੂੰ ਹਾਇਰ ਕਰਕੇ ਹੋਰ ਤਰੀਕਾ ਤਾਂ ਮੇਰੀਆਂ ਨਜ਼ਰਾਂ 'ਚ ਤਾਂ ਇਹ ਹੀ ਤਰੀਕਾ ਹੈ ਹਾਂ ਜਿਹੜੀ ਅਕਾਊਂਟਸ ਨੇ ਬਿਜਨਸ ਦੇ ਇਹਦੇ ਵਿੱਚ ਘਪਲਾ ਹੋ ਰਿਆ ਕਿਉਂਕਿ ਜ ਮੈਂ ਤਾਂ ਮੈਂ ਆਪਣੇ ਆਕਾਊਂਟਸ ਬਣਾ ਕੇ ਚਲੀ ਜਾਂਦੀ ਹਾਂ ਬਾਅਦ ਜਿਹੜੇ ਵਰਕਰਸ ਆ ਉਹ ਪਤਾ ਨਹੀਂ ਕੀ ਕਰ ਲੈਂਦੇ ਆ ਫਿਰ ਅਕਾਊਂਟ ਵਿੱਚ ਸਰ ਉਹਨਾਂ ਕਰਕੇ ਜਿਹੜਾ ਇਹ ਤੁਸੀਂ ਦੇਖ ਰਹੇ ਹਾਂ ਕਿ ਤੁਸੀਂ ਆਪਣਾ ਬਿਜਨਸ ਐਨਾਲਾਈਜ ਕੀਤਾ ਸੀ ਅਤੇ ਉਹ ਅਕਾਊਂਟਸ ਵਿੱਚ ਕੁਛ ਗੜਬੜ ਹੋ ਰਹੀ ਹੈ ਇਸੇ ਕਰਕੇ ਹੋ ਰਹੀ ਹੈ ਕਿ ਜਿਹੜੇ ਦੂਜੇ ਵਰਕਰ ਨੇ ਉਹ ਆਪਣੇ ਪ੍ਰੋਫਿਟ ਲਈ ਆਪਣੇ ਪ੍ਰੋਫਿਟ ਲਈ ਦੂਜੇ ਅਕਾਊਂਟਸ ਵਿੱਚ ਘਪਲਾ ਕਰ ਰਹੇ ਨੇ ਅਤੇ ਜੇ ਇਹ ਹੀ ਆਪਾਂ ਕੁਛ ਹੋਰ ਆਪਣੇ ਜਿਹੜਾ ਆਪਣੀ ਸਰਵਿਸਸ ਆ ਉਹਦੇ ਵਿੱਚ ਕੋਈ ਸੁਧਾਰ ਕਰ ਦਈਏ ਤਾਂ ਆਪਣਾ ਜਿਹੜਾ ਜਿਹੜੇ ਅਕਾਊਂਟਸ ਨੇ ਉਹ ਜੇ ਆਪਣੇ ਅਕਾਊਂਟਸ ਗਿਰ ਗਏ ਫਿਰ ਵੀ ਤਾਂ ਆਪਾਂ ਨੂੰ ਘਾਟਾ ਹੀ ਪਊਗਾ

ਤਾਂ ਮੈਂ ਕਿਵੇਂ ਲੱਭ ਸਕਦੀ ਹਾਂ ਤੁਸੀਂ ਪੁਲਿਸ ਨੂੰ ਕਹਿ ਦਓ ਕਿ ਉਹ ਮਤਲਬ ਅ ਉਹਨਾਂ ਨੂੰ ਤੁਸੀਂ ਇੰਨਵੈਸੀ ਇੰਨਵੈਸਟੀਗੇਟ ਕਰਨ ਨੂੰ ਕਹੋ

ਤੁਸੀਂ ਇੱਕ ਲੋਇਰ ਹਾਇਰ ਕਰ ਸਕਦੇ ਹਾਂ ਜਿ ਜਿਹੜਾ ਆਪਣਾ ਕੇਸ ਸੰਭਾਲੇਗਾ ਹਾਂਜੀ ਹ ਹਾਂਜੀ ਉਵੇਂ ਫਿਰ ਆਪਣੀ ਪ੍ਰੋਬਲਮ ਸ਼ਾਇਦ ਹੀ ਸਹੀ ਹੋ ਸਕਦੀ ਹੈ ਜੇ ਉਹ ਜੇ ਉਹ ਵਰਕਰ ਵੀ ਫੜਿਆ ਗਿਆ ਫਿਰ ਵੀ ਆਪਣਾ ਸਹੀ ਨਹੀਂ ਹੋਣਾ ਇਸ ਲਈ ਆਪਾਂ ਨੂੰ ਇੱਕ ਹੋਰ ਅਕਾਊਂਟੈਂਟ ਹਾਇਰ ਕਰਨਾ ਹੀ ਪੈਣਾ ਹਾਂਜੀ ਹਾਂਜੀ